ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਆਪ ਜ਼ਰੂਰੀ ਸਮਝਾਂਗਾ ਕਿ ਪੰਜਾਬ ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਕੋਈ ਵੀ ਫ਼ਸਲ ਹੈ ਕੋਈ ਵੀ ਫ਼ਸਲ ਤੋਂ ਇਲਾਵਾ ਹੋਰ ਕੋਈ ਵੀ ਸਬਜ਼ੀ ਹੈ ਕੋਈ ਵੀ ਪ ਆਪਾਂ ਖਣਿਜ ਹੈ ਉਹ ਪੰਜਾਬ ਵਿੱਚ ਹਰ ਇੱਕ ਖਣਿਜ ਪ੍ਰਾਪਤ ਹੋ ਸਕਦਾ ਪੰਜਾਬ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੁਆਰਾ ਸਿਰਜੀ ਗਈ ਇੱਕ ਬਹੁਤ ਸੋਹਣੀ ਧਰਤੀ ਹੈ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਪਰ ਸਾਡੇ ਦਿਲ ਅੰਦਰੋਂ ਪੰਜਾਬ ਦਾ ਜੋ ਨਾਮ ਹੈ ਉਹ ਕਦੇ ਵੀ ਨਹੀਂ ਭੁੱਲਦਾ ਇਹ ਸਾਡੇ ਸਦਾ ਦਿਲਾਂ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਪੰਜਾਬ ਜੇ ਦੂਸਰੇ ਪੱਖ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਪਾਣੀ ਦੀ ਬਹੁਤ ਜ਼ਿਆਦਾ ਵ ਵਧੀਆ ਪ੍ਰਣਾਲੀ ਹੈ ਪਾਣੀ ਬਹੁਤ ਹੀ ਵਧੀਆ ਅਤੇ ਸੁਚਾਰੂ ਢੰਗ ਨਾਲ ਵਰਤਿਆ ਜਾਂਦਾ ਹੈ ਦਿਨੋ ਦਿਨ ਹਾਲਾਂਕਿ ਦਿਨੋ ਦਿਨ ਅਸੀਂ ਮਨੁੱਖੀ ਗਤੀਵਿਧੀਆਂ ਕਾਰਨ ਪਾਣੀ ਜਾਂ ਹੋਰ ਵੀ ਕਈ ਖਣਿਜ ਦੀ ਮਾਤਰਾ ਪੰਜਾਬ ਵਿੱਚੋਂ ਘੱਟ ਰਹੀ ਹੈ ਜਿਵੇਂ ਕਿ ਅਸੀਂ ਦੇਖਦੇ ਹੀ ਹਾਂ ਕਿ ਸਾਡੇ ਪਿੰਡ ਅੰਦਰ ਪਾਣੀ ਦੀ ਜ਼ਿਆਦਾ ਦੁਰਵਰਤੋਂ ਕਾਰਨ ਪਾਣੀ ਦੀ ਬੇਸਟੇਜ ਹੁੰਦਿਆਂ ਦੇਖ ਕੇ ਮੈਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਕਿਤੇ ਪੰਜਾਬ ਵਿੱਚੋਂ ਪਾਣੀ ਖ਼ਤਮ ਹੀ ਨਾ ਹੋ ਜਾਵੇ ਇਸ ਲਈ ਸਾਨੂੰ ਲੋੜ ਹੈ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਪਾਣੀ ਦੀ ਸਹੀ ਵਰਤੋਂ ਅਤੇ ਸੰਯਮ ਨਾਲ ਵਰਤੋਂ ਕਰਕੇ ਇਹਨਾਂ ਨੂੰ

ਸੰਯਮ ਨਾਲ ਵਰਤੋਂ ਕਰਕੇ ਉਹਨਾਂ ਨੂੰ ਵੀ ਅਸੀਂ ਸੰਭਾਲ ਸਕੀਏ ਅਤੇ ਨਾਲ ਹੀ ਮੈਂ ਇਹ ਕ ਕਰਨਾ ਚਾਹੁੰਦਾ ਹਾਂ ਕਿ ਵੱ ਵੱਧ ਤੋਂ ਵੱਧ ਲੋਕਾਂ ਨੂੰ ਇਨ ਇਸ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਜਾਵੇ ਵੱਖ ਵੱਖ ਪ੍ਰਕਾਰ ਦੇ ਪ੍ਰੋਗਰਾਮ ਕਰਵਾਏ ਜਾਣ ਦਰੱਖਤ ਲਗਾਏ ਜਾਣ ਤਾਂ ਜੋ ਅਸੀਂ ਆਪਣੇ ਸੋਹਣੇ ਪੰਜਾਬ ਨੂੰ ਇਸ ਤਰ੍ਹਾਂ ਖੁਸ਼ਹਾਲ ਰੱਖ ਸਕੀਏ